ਪੰਜਾਬ ਵਿੱਚ ਮੁੱਖ ਕਾਰੋਬਾਰ ਟਰੈਵਲ ਏਜੰਸੀ ਹੈ ਲੋਕ ਬਾਹਰੋਂ ਬਹੁਤ ਹੀ ਘੁੰਮਣ ਫਿਰਨ ਲਈ ਪੰਜਾਬ ਆਉਂਦੇ ਹਨ ਹਰ ਸਾਲ ਬਹੁਤ ਜ਼ਿਆਦਾ ਟੂਰਿਸਟ ਪੰਜਾਬ ਆਉਂਦੇ ਹਨ ਖਾਸ ਕਰਕੇ ਅੰਮ੍ਰਿਤਸਰ ਇਸ ਲਈ ਟਰੈਵਲ ਏਜੰਸੀ ਕਈ ਵੈਬਸਾਈਟਾਂ ਨਾਲ ਲਿੰਕ ਹੁੰਦੀ ਹੈ ਜਿਸ ਰਾਹੀਂ ਅਸੀਂ ਹੋਟਲ ਕੈਬ ਵਗੈਰਾ ਜਹਾਜ਼ਾਂ ਦੀਆਂ ਟਿਕਟਾਂ ਟਰੇਨਾਂ ਬੱਸਾਂ ਆਦਿ ਬੁੱਕ ਕਰ ਸਕਦੇ ਹਾਂ ਅਤੇ ਇਸ ਵਿੱਚ ਬਹੁਤ ਹੀ ਫਾਇਦਾ ਹੁੰਦਾ ਹੈ ਕਿਉਂਕਿ ਹਰ ਸਾਲ ਬਾਹਰੋਂ ਟੂਰਿਸਟ ਪੰਜਾਬ ਵਿੱਚ ਘੁੰਮਣ ਆਉਂਦੇ ਹਨ ਖਾਸ ਮੌਕਿਆਂ ਉੱਤੇ ਤਿਉਹਾਰਾਂ ਉੱਤੇ ਵੀ ਆਉਂਦੇ ਹਨ ਅਤੇ ਇੱਥੋਂ ਆਪਣੇ ਘਰਦਿਆਂ ਨੂੰ ਵੀ ਨਾਲ ਲੈ ਕੇ ਘੁੰਮਾਉਣ ਆਉਂਦੇ ਹਨ ਪੰਜਾਬ ਇੱਕ ਬਹੁਤ ਹੀ ਵਧੀਆ ਜਗ੍ਹਾ ਹੈ ਅਤੇ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਲਈ ਲੋਕ ਬਾਹਰੋਂ ਆ ਕੇ ਪੰਜਾਬ ਵਿੱਚ ਘੁੰਮਦੇ ਹਨ ਖਾਸ ਕਰਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਹਨ ਅਤੇ ਹੋਰ ਵੀ ਕਈ ਪਵਿੱਤਰ ਮੰਦਿਰ ਅਤੇ ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਨ ਜਿਸ ਲਈ ਇੱਥੇ ਟੂਰਿਸਟ ਦੇ ਸਪੋਟ ਬਹੁਤ ਜ਼ਿਆਦਾ ਹੈ ਅਤੇ ਟਰੈਵਲ ਏਜੰਸੀ ਦਾ ਕੰਮ ਬਹੁਤ ਵੱਡੇ ਪੱਧਰ 'ਤੇ ਹੈ